ਮੇਰੇ ਹਿਸਾਬ ਨਾਲ ਪੰਜਾਬੀ ਭਾਸ਼ਾ ਬੋਲਣ ਵਾਲੇ ਨੂੰ ਕਿਸੇ ਵੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਪੰਜਾਬੀ ਇੱਕ ਐਸੀ ਭਾਸ਼ਾ ਹੈ ਜੋ ਕਿ ਲਗਭਗ ਹਰੇਕ ਖੇਤਰ ਵਿੱਚ ਥੋੜ੍ਹੇ ਪਰਸੈਂਟ ਤਾਂ ਬੋਲੀ ਜਾਂਦੀ ਹੈ ਜ਼ਿਆਦਾ ਨਹੀਂ ਤਾਂ ਥੋੜ੍ਹੇ ਬਹੁਤ ਤਾਂ ਬੋਲੀ ਜਾ ਰਹੀ ਆ ਕੁਛ ਨਾ ਕੁਛ ਐਵੇਂ ਹੈ ਹੀ ਹੈ ਬਹੁਤ ਜ਼ਿਆਦਾ ਲੋਕ ਇੱਧਰ ਉੱਧਰ ਰਹਿ ਰਹੇ ਆ ਕਿ ਪੰ ਜੋ ਕਿ ਪੰਜਾਬੀ ਬੋਲ ਰਹੇ ਹੈ ਅਗਰ ਆਪਾਂ ਦੂਜੇ ਰਾਜਾਂ ਦੀ ਗੱਲ ਕਰੀਏ ਹਿਮਾਚਲ ਦੀ ਗੱਲ ਕਰੀਏ ਜਾਂ ਫਿਰ ਹੋਰ ਵੀ ਕਿਤੇ ਵੀ ਕੋਈ ਵੀ ਰਾਜ ਦੀ ਗੱਲ ਕਰੀਏ ਤਾਂ ਪੰਜਾਬੀ ਬੋਲੀ ਜਾਂਦੀ ਹੈ ਤਾਂ ਸਾਨੂੰ ਸਰਵਾਈਵ ਕਰਨਾ ਵੀ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਅਗਰ ਅੰਤਰਰਾਸ਼ਟਰੀ ਦੀ ਗੱਲ ਕਰੀਏ ਤਾਂ ਉੱਥੇ ਵੀ ਪੰਜਾਬੀ ਬਹੁਤ ਜ਼ਿਆਦਾ ਬੋਲੀ ਜਾਂਦੀ ਹੈ ਹੁਣ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਕਨੇਡਾ ਉੱਥੇ ਵੀ ਕਿਹਾ ਗਿਆ ਹੈ ਕਿ ਪੰਜਾਬੀ ਉਨ੍ਹਾਂ ਦੀ ਦੂਜੀ ਭਾਸ਼ਾ ਹੈ ਕਿਉਂਕਿ ਉੱਥੇ ਜ਼ਿਆਦਾਤਰ ਲੋਕ ਪੰਜਾਬੀ ਹੀ ਰਹਿ ਰਹੇ ਹਨ ਜਿਹੜੇ ਕੰਮ ਕਰ ਰਹੇ ਆ ਉੱਥੇ ਰਹਿ ਰਹੇ ਆ ਸਾਰੇ ਪੰਜਾਬੀ ਆ ਉਹਨਾਂ ਨੂੰ ਕੋਈ ਮੇਰੇ ਮੇਰੇ ਹਿਸਾਬ ਨਾਲ਼ ਤਾਂ ਪੰਜਾਬੀ ਬੋਲਣ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਿਤੇ ਵੀ